ਹੈਲੋ ਸਤਿ ਸ਼੍ਰੀ ਅਕਾਲ ਜੀ ਸੱਚੀ ਭਾਅ ਜੀ ਅਤੇ ਤੁਹਾਨੂੰ ਕੀ ਲੱਗਦਾ ਪੰਜਾਬ ਕੀ ਕੋਂਟਰੀਬਿਊਟ ਕਰੇਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਇਸ ਬਾਰੇ ਤਾਂ ਮੇਰੀ ਇਹੀ ਰਾਏ ਸੱਚੀ ਕੋਂਟਰੀਬਿਊਟ ਕਰੇਗਾ ਜੇ ਜ਼ਿਆਦਾਤਰ ਚੀਜ਼ਾਂ ਸਾਡੇ ਇੱਧਰ ਬਣੇ ਕਦੀਆਂ ਤਾਂ ਸੱਚੀ ਕੋਂਟਰੀਬਿਊਟ ਕਰੇਗਾ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਧੰਨਵਾਦ ਜੀ